ਪੰਜਾਬ ਦੇ ਲੋਕ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਇਸ ਕਰਕੇ ਕਈ ਵਾਰੀ ਬਾਹਰਲੇ ਲੋਕ ਆ ਕੇ ਕਹਿੰਦੇ ਨੇ ਪੰਜਾਬੀ ਬਹੁਤ ਖਾਂਦੇ ਨੇ ਇਸ ਕਰਕੇ ਜੇ ਪੰਜਾਬ 'ਚ ਆਏ ਤਾਂ ਪੰਜਾਬ ਦਾ ਖਾਣਾ ਪੀਣਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਜਿਹਨੇ ਨਹੀਂ ਖਾਧੀ ਉਹਨੇ ਪੰਜਾਬ ਦਾ ਕੁਝ ਵੀ ਨਹੀਂ ਖਾਧਾ ਕੋਈ ਸਮਾਂ ਸੀ ਪੰਜਾਬ ਦੇ ਲੋਕ ਦੇਸੀ ਘਿਓ ਦੀਆਂ ਚੂਰੀਆਂ ਅਤੇ ਲੱਸੀਆਂ ਬਹੁਤ ਪੀਂਦੇ ਸੀ ਪਰ ਅੱਜ ਖਾਣ ਪੀਣ ਬਦਲ ਗਿਆ ਖਾਣ ਪੀਣ ਬਦਲ ਗਿਆ ਵੱਡੇ ਵੱਡੇ ਰੈਸਟੋਰੈਂਟ ਖੁੱਲ੍ਹ ਗਏ ਵੱਡੇ ਵੱਡੇ ਢਾਬੇ ਖੁੱਲ੍ਹ ਗਏ ਕਈ ਵਾਰੀ ਅੰਮ੍ਰਿਤਸਰ ਜਾਈਦਾ ਇਤਿਹਾਸਿਕ ਸ਼ਹਿਰ ਦੇ ਵਿੱਚ ਜਾਈ ਦਾ ਗੁਰੂ ਕੀ ਨਗਰੀ ਤਾਂ ਉੱਥੇ ਵੀ ਭਰਾਵਾਂ ਦਾ ਢਾਬਾ ਕੇਸਰੀ ਢਾਬਾ ਬਹੁਤ ਮਸ਼ਹੂਰ ਹੈ ਭਰਾਵਾਂ ਦੇ ਢਾਬੇ ਦਾ ਲਾਜਵਾਬ ਬੋਲੀਵੁੱਡ ਤੱਕ ਚਰਚਾ ਮੁੰਬਈ ਤੱਕ ਚਰਜਾ ਚਰਚਾ ਹੈ ਪੰਜਾਬ ਦੇ ਸਿੰਗਰ ਆ ਉੱਥੇ ਆਉਂਦੇ ਨੇ ਇਸ ਤਰ੍ਹਾਂ ਬਠਿੰਡੇ ਆਪਣੇ ਸ਼ਹਿਰ ਦੀ ਗੱਲ ਕਰੀਏ ਤਾਂ ਸਰਦਾਰਾਂ ਦਾ ਢਾਬਾ ਬਹੁਤ ਮਸ਼ਹੂਰ ਹੈ ਸਰਦਾਰ ਢਾਬਾ ਕਦੇ ਵੀ ਬਠਿੰਡੇ ਆਉਣਾ ਹੋਵੇ ਅਮਰੀਕ ਸਿੰਘ ਰੋਡ 'ਤੇ ਜਦੋਂ ਆਪਾਂ ਜਾਂਦੇ ਹਾਂ ਅਮਰੀਕ ਸਿੰਘ ਰੋਡ 'ਤੇ ਜਾਂਦੇ ਹਾਂ ਤਾਂ ਅਮਰੀਕ ਦਾ ਢਾਬਾ ਅਮਰੀਕ ਦਾ ਢਾਬਾ ਵੀ ਬਹੁਤ ਮਸ਼ਹੂਰ ਹੈ ਕਿਉਂਕਿ ਅਮਰੀਕ ਦਾ ਢਾਬਾ ਇਹਦੇ ਵਿੱਚ ਤੁਸੀਂ ਗੱਲ ਕਰੋ ਤੁਹਾਨੂੰ ਨੋਨ ਵੈਜ ਤੋਂ ਲੈ ਕੇ ਵੈਜ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਰਾਤ ਦੇ ਗਿਆਰਾਂ ਵਜੇ ਤੱਕ ਹਰ ਚੀਜ਼ ਦਾ ਟੇਸਟ ਮਿਲੇਗਾ ਬਠਿੰਡਾ ਦੇ ਵਿੱਚ ਤੁਸੀਂ ਬਾਹਰ ਜਦੋਂ ਬਾਈਪਾਸ ਰੋਡ ਨੂੰ ਜਾਣੇ ਹੋ ਬਰਨਾਲਾ ਜੇ ਤੁਸੀਂ ਬਾਹਰ ਦੀ ਆਉਂਦੇ ਹੋ ਕਿਤੇ ਮੁਕਤਸਰ ਸਾਈਡ 'ਤੇ ਆ ਰਹੇ ਹੋ ਕੋਟਕਪੂਰੇ ਸਾਈਡ 'ਤੇ ਇੱਧਰੋਂ ਅ ਪਟਿਆਲੇ ਵੱਲ ਨੂੰ ਜਾਣਾ ਬਾਈਪਾਸ ਤੋਂ ਆ ਰਹੇ ਹੋ ਤੁਹਾਨੂੰ ਕਿਤੇ ਨੇੜੇ ਢਾਬਾ ਚਾਹੀਦਾ ਜਾਂ ਰੈਸਟੋਰੈਂਟ ਚਾਹੀਦਾ ਤਾਂ ਮਹਿਲ ਡੀਲੈਕਸ ਵਰਗਾ ਲਾਜਵਾਬ ਖਾਣਾ ਇੱਥੋਂ ਕਿਤੇ ਨਹੀਂ ਮਿਲਣਾ ਬਰਾਈਸ ਮੌਲ ਦੇ ਨਾਲ ਹੀ ਮਹਿਲ ਡੀਲੈਕਸ ਹੈ ਅਸੀਂ ਵੀ ਕਿਸੇ ਫਰੈਂਡਸ ਦੀ ਪਾਰਟੀ ਕਰਨ ਦੇ ਲਈ ਰਾਤ ਦਾ ਡਿਨਰ ਰੱਖਿਆ ਸੀ ਤਾਂ ਲਾਜਵਾਬ ਹਰ ਤਰ੍ਹਾਂ ਦਾ ਚਿਕਨ ਹਰ ਤਰ੍ਹਾਂ ਦਾ ਵਰਾਇਟੀ ਵੈਜ ਨੋਨ ਵੈਜ ਸਭ ਤੁਹਾਨੂੰ ਉੱਥੇ ਮਿਲਦੀ ਹੈ ਅਸੀਂ ਇੱਕ ਵਾਰ ਤਾਂ ਯਾਦ ਹੈ ਵੀ ਅਸੀਂ ਉਹਨੂੰ ਕਹਿ ਤਾਂ ਵੀ ਕੇ ਐਫ ਸੀ ਟਾਈਪ ਚਿਕਨ ਦਿਓ ਅਤੇ ਕੇ ਐਫ ਸੀ ਟਾਈਪ ਚਿਕਨ ਇੰਨਾ ਵਧੀਆ ਉਹਨੇ ਬਣਾਇਆ ਬਹੁਤ ਵਧੀਆ ਰਿਹਾ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਟੂਲਿਪ ਕਲੱਬ ਹੈ ਟੂਲਿਪ ਦੇ ਕਲੱਬ ਵਿੱਚ ਤੁਸੀਂ ਫੈਮਲੀ ਦੇ ਨਾਲ ਖਾਣਾ ਖਾ ਸਕਦੇ ਹੋ ਟੂਰਿਸਟ ਜਿਹੜੇ ਵੀ ਆਉਂਦੇ ਨੇ ਟੂਰਿਸਟ ਨੇ ਆਉਣਾ ਤਾਂ ਬਠਿੰਡਾ ਦੇ ਵਿੱਚ ਜੂ ਹੈ ਫੋਰਟ ਹੈ ਤਾਂ ਜਦੋਂ ਵੀ ਉਹ ਇੱਥੇ ਆਉਂਦੇ ਨੇ ਉਹ ਸਾਰਾ ਮੈਨੂੰ ਪ੍ਰੋਵਾਈਡ ਰਹਿੰਦਾ ਵੀ ਤੁਸੀਂ ਕਿੱਥੇ ਰੈਸਟੋਰੈਂਟ ਅਤੇ ਜਾਣਾ ਤੁਹਾਨੂੰ ਈਜ਼ੀ ਈਜ਼ੀ ਵੇ ਕਿੱਥੇ ਆ ਔਰ ਕਿੱਥੇ ਹੈਲਦੀ ਔਰ ਵੈਲਦੀ ਖਾਣਾ ਤੁਹਾਨੂੰ ਮਿਲਣਾ ਹਰ ਜਗ੍ਹਾ ਤੁਹਾਨੂੰ ਕਿਲ੍ਹਾ ਫੋਰ ਅ ਫੋਰਟ ਹੈ ਜੂ ਹੈ ਹਾਜੀ ਰਤਨ ਬਾਬਾ ਜੀ ਹੈ ਆ ਸਟੇਡੀਅਮ ਦੇ ਨੇੜੇ ਤੇੜੇ ਹਰ ਜਗ੍ਹਾ ਤੁਹਾਨੂੰ ਐਵਲੇਬਲ ਕਾਫ਼ੀ ਅੱਛਾ ਖਾਣਾ ਮਿਲਦਾ ਸਟੀਲਾ ਹੋਟਲ ਹੈ ਅਮਰੀਕ ਸਿੰਘ ਦਾ ਢਾਬਾ ਹੈ ਕੇ ਐਫ ਸੀ ਹੈ ਅੱਜ ਕੱਲ੍ਹ ਤਾਂ ਹਰ ਜਗ੍ਹਾ ਹੈ ਇਹਨਾਂ ਦੇ ਆਊਟਲੈਟ ਪਲਾਂਟਸ